ਮੈਂ ਸਿੱਖ ਧਰਮ ਤੋਂ ਬਿਲੋਂਗ ਕਰਦੀ ਹਾਂ ਮੈਂ ਇੱਕ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਈ ਹਾਂ ਮੇਰੇ ਲਈ ਸਾਰੇ ਹੀ ਧਰਮ ਇੱਕ ਬਰਾਬਰ ਨੇ ਕੋਈ ਧਰਮ ਨਹੀਂ ਉੱਚਾ ਜਾਂ ਨੀਵਾਂ ਨਹੀਂ ਹੁੰਦਾ ਰੱਬ ਇੱਕ ਹੁੰਦਾ ਹੈ ਮੈਂ ਇਸ ਧਰਮ ਦੇ ਵਿੱਚ ਜੰਮੀ ਪਲੀ ਹਾਂ ਇਸ ਲਈ ਮੈਨੂੰ ਜ਼ਿਆਦਾ ਜਾਣਕਾਰੀ ਇਸ ਧਰਮ ਦੀ ਹੈ ਮੇਰੀ ਸਾਰੀ ਵੀ ਨੌਲੇਜ ਜਾਂ ਫਿਰ ਜਾਣਕਾਰੀ ਸਿੱਖ ਧਰਮ ਬਾਰੇ ਆਪਣੇ ਵੱਡਿਆਂ ਤੋਂ ਆਪਣੇ ਦਾਦਾ ਜੀ ਤੋਂ ਦਾਦੀ ਜੀ ਤੋਂ ਮੰਮਾ ਪਾਪਾ ਤੋਂ ਮਿਲੀ ਆ ਸਿੱਖ ਧਰਮ ਦੇ ਵਿੱਚ ਦਸ ਗੁਰੂ ਸਾਹਿਬਾਨ ਹਨ ਪੰਜ ਪਿਆਰੇ ਹਨ ਅਤੇ ਚਾਰ ਸਾਹਿਬਜ਼ਾਦੇ ਹਨ ਸਿੱਖ ਧਰਮ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਅਤੇ ਸਿੱਖ ਧਰਮ ਦੇ ਮਰਿਆਦਾ ਅਨੁਸਾਰ ਇੱਕ ਲੰਗਰ ਦੀ ਪ੍ਰਥਾ ਚਲਾਈ ਜਾਂਦੀ ਹੈ ਜਿਹਦੇ ਵਿੱਚ ਕਿ ਹਰ ਕੋਈ ਧਰਮ ਦਾ ਇਨਸਾਨ ਆ ਕੇ ਲੰਗਰ ਛਕ ਸਕਦਾ ਹੈ ਜਿਹੜੀ ਲੰਗਰ ਦੀ ਪ੍ਰਥਾ ਗੁਰੂ ਨਾਨਕ ਦੇਵ ਜੀ ਨੇ ਚਲਾਈ ਸੀ ਅਤੇ ਸਿੱਖ ਧਰਮ ਦੇ ਵਿੱਚ ਬਹੁਤ ਸਾਰੇ ਗੁਰਦੁਆਰੇ ਹਨ ਇਤਿਹਾਸਿਕ ਗੁਰਦੁਆਰੇ ਹਨ ਜਿਵੇਂ ਕਿ ਪੰਜ ਤਖਤ ਵੀ ਹਨ ਸਿੱਖ ਧਰਮ ਦੇ ਗੁਰਦੁਆਰਿਆਂ ਦੇ ਵਿੱਚ ਕੋਈ ਮਨਾਹੀ ਨਹੀਂ ਆ ਹਰ ਕੋਈ ਧਰਮ ਦਾ ਉੱਚਾ ਨੀਵਾਂ ਕੋਈ ਨਹੀਂ ਦੇਖਿਆ ਜਾਂਦਾ ਹਰ ਕੋਈ ਧਰਮ ਦਾ ਇਨਸਾਨ ਆ ਕੇ ਮੱਥਾ ਟੇਕ ਸਕਦਾ ਗੁਰੂ ਸਾਹਿਬਾਨ ਦੀ ਹਜ਼ੂਰੀ ਵਿੱਚ ਅਤੇ ਅਤੇ ਲੰਗਰ ਛਕ ਸਕਦਾ ਸਿੱਖ ਦਰਬਾਰ ਦੇ ਚਾਰ ਦਰਵਾਜ਼ੇ ਹਨ ਕਿ ਕੋਈ ਵੀ ਧਰਮ ਦਾ ਇਨਸਾਨ ਆ ਸਕਦਾ ਮੱਥਾ ਟੇਕ ਸਕਦਾ ਵਾ ਅਤੇ ਗੁਰੂ ਸਾਹਿਬਾਨ ਨੂੰ ਮੰਨ ਸਕਦਾ ਆ ਅਤੇ ਇਹਦੇ ਵਿੱਚ ਕੋਈ ਵੀ ਉੱਚਾ ਜਾਂ ਨੀਵੇਂ ਵਾਲੀ ਗੱਲ ਨਹੀਂ ਹੁੰਦੀ ਹਰ ਧਰਮ ਇੱਕ ਬਰਾਬਰ ਆ ਕਿਉਂਕਿ ਰੱਬ ਇੱਕ ਆ ਆਪਣਾ ਗੁਰੂ ਇੱਕ ਆ